ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਿਮਰਨਜੀਤ ਕੌਰ ਜੀ ਗੱਲ ਕਰ ਰਹੇ ਹੋ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੇਰਾ ਜਿਹੜਾ ਤੁਹਾਡਾ ਰੈਫਰਸ ਜਿਹੜਾ ਸੀ ਅਨੀਤਾ ਰਾਣੀ ਜੋ ਤੁਹਾਡੇ ਦੋਸਤ ਨੇ ਉਹਨਾਂ ਦਿੱਤਾ ਸੀ ਹਾਂਜੀ ਹਾਂਜੀ ਤੁਹਾਨੂੰ ਦੱਸਿਆ ਹੋਣਾ ਉਹਨਾਂ ਨੇ ਮੈਂ ਕੇਰਲਾ ਤੋਂ ਆਇਆ ਵਾਂ ਮੈਂ ਪੰਜਾਬ ਘੁੰਮ ਰਿਹਾ ਸੀ ਹਾਂਜੀ ਤੇ ਮੈਂ ਵੱਖਰੀਆਂ ਵੱਖਰੀਆਂ ਕਿੱਦਾਂ ਆਪਣੇ ਜਿਹੜੇ ਸਟੇਟਸ ਹੈਗੀਆਂ ਵਾ ਰਾਜ ਹੈਗੇ ਆ ਘੁੰਮ ਰਿਹਾ ਵਾ ਤੇ ਮੈਂ ਪੰਜਾਬ ਘੁੰਮਦਾ ਘੁੰਮਦਾ ਹੁਣ ਮੈਂ ਕਪੂਰਥਲਾ ਪਹੁੰਚਿਆ ਸੀ ਤੇ ਮੈਂ ਨੰਬਰ ਤੁਹਾਡਾ ਮੈਨੂੰ ਸੈਂਡ ਕੀਤਾ ਸੀ ਭੇਜਿਆ ਸੀ ਤੇ ਮੈਂ ਤੁਹਾਨੂੰ ਪੁੱਛਣਾ ਸੀ ਕਪੂਰਥਲਾ ਦੇ ਬਾਰੇ ਕਪੂਰਥਲਾ ਦੇ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਹ ਦੇਖ ਸਕਦੇ ਹ ਜਿਹੜੀ ਆਪਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸ਼ਾਲੀਮਾਰ ਬਾਗ ਦੇ ਵਿੱਚ ਕੀ ਖਾਸ ਹੈ ਮੈਡਮ ਠੀਕ ਆ ਜੀ ਠੀਕ ਹੈ ਜੀ ਤੁਸੀਂ ਰਿਪੀਟ ਕਰੋਗੇ ਸ਼ਾਲੀਮਾਰ ਬਾਗ ਹਾਂਜੀ ਮੈਂ ਲਿਖ ਰਿਹਾ ਵਾਂ ਸ਼ਾਲੀਮਾਰ ਬਾਗ ਠੀਕ ਆ ਜੀ ਸ਼ਾਲੀਮਾਰ ਬਾਗ ਤੋਂ ਇਲਾਵਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਸ਼ਾਲੀਮਾਰ ਬਾਗ ਤੋਂ ਇਲਾਵਾ ਤੁਸੀਂ ਕਿਹਾ ਸੀ ਕੁਛ ਸਾਇੰਸ ਸਿਟੀ ਦਾ ਨਾਮ ਲੈ ਰਹੇ ਸੀ ਠੀਕ ਹੈ ਜੀ ਅੱਛਾ ਜੀ ਸਾਇੰਸ ਸਿਟੀ ਵਿੱਚ ਕੀ ਖਾਸ ਵਿਸ਼ੇਸ਼ ਜਿਹੜਾ ਹੈਗਾ ਵਾ ਜਿਹੜਾ ਮਤਲਬ ਠੀਕ ਹੈ ਜੀ ਵੈਸੇ ਵੀ ਮੇਰਾ ਸਾਇੰਸ ਵਿੱਚ ਬਹੁਤ ਹੀ ਦਿਲਚਸਪੀ ਹੈਗੀ ਆ ਮੇਰੀ ਮੇਰੀ ਰੁਚੀ ਹੈਗੀ ਆ ਠੀਕ ਹੈ ਜੀ ਠੀਕ ਆ ਜੀ ਰਪੀਟ ਕਰਨਾ ਕਿੰਨੇ ਪੈਸੇ ਤੁਸੀਂ ਇਹ ਸਮਾਂ ਦੱਸ ਸਕਦੇ ਹੋ ਸਾਇੰਸ ਸਿਟੀ ਦਾ ਸਮਾਂ ਕਿੰਨੇ ਤੋਂ ਕਿੰਨੇ ਠੀਕ ਹੈ ਜੀ ਹਾਂਜੀ ਸਾਈ ਠੀਕ ਹੈ ਜੀ ਸ਼ਾਲੀਮਾਰ ਬਾਗ ਤੋਂ ਬਾਅਦ ਸਾਇੰਸ ਸਿਟੀ ਤੁਸੀਂ ਇੱਕ ਨਾਮ ਇੱਕ ਦੋ ਜਗਾ ਦਾ ਨਾਮ ਤੁਸੀਂ ਹੋਰ ਲੈ ਰਹੇ ਸੀ ਕੀ ਖਾਸ ਹੈ ਮੈਡਮ ਕਾਂਜਲੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮੈਡਮ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੈਂ ਇੱਥੇ ਚਾਰ ਪੰਜ ਦਿਨ ਸਟੇਅ ਕਰਾਂਗਾ ਤਾਂ ਜੋ ਤੁਸੀਂ ਦੱਸਿਆ ਵਾ ਇਹਨਾਂ ਨੇ ਸਥਾਨਾਂ ਨੂੰ ਜਰੂਰ ਇੱਕ ਵਾਰ ਜਾ ਕੇ ਦੇਖੂਗਾ ਮੈਂ ਧੰਨਵਾਦ ਮੈਡਮ ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ